ਭਾਰਤ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਮੌਸਮ ਹਨ ਉਸੇ ਤਰ੍ਹਾਂ ਹੀ ਖਾਣਾ ਵੀ ਮੌਸਮ ਅਨੁਸਾਰ ਕਈ ਤਰ੍ਹਾਂ ਦਾ ਬਣਦਾ ਹੈ ਗਰਮੀਆਂ ਦੇ ਵਿੱਚ ਜ਼ਿਆਦਾਤਰ ਦਾਲਾਂ ਹੀ ਬਣਾਈਆਂ ਜਾਂਦੀਆਂ ਹਨ ਕਿਉਂਕਿ ਗਰਮੀਆਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਘਈਆ ਘਈਆ ਤੋਰੀ ਚੱਪਣ ਕੱਦੂ ਇਸ ਤਰ੍ਹਾਂ ਦੀਆਂ ਸਬਜ਼ੀਆਂ ਬੱਚੇ ਪਸੰਦ ਨਹੀਂ ਕਰਦੇ ਖਾਣਾ ਇਸ ਲਈ ਅ ਗਰਮੀਆਂ ਦੇ ਵਿੱਚ ਦਾਲਾਂ ਜ਼ਿਆਦਾ ਬਣਾਈਆਂ ਜਾਂਦੀਆਂ ਹਨ ਭਿੰਡੀ ਇੱਕ ਐਸੀ ਸਬਜ਼ੀ ਹੈ ਗਰਮੀਆਂ ਦੇ ਵਿੱਚ ਜਿਹਨੂੰ ਬੱਚੇ ਪਸੰਦ ਕਰਦੇ ਹਨ ਸਰਦੀਆਂ ਦੀਆਂ ਸਬਜ਼ੀਆਂ ਜਿਵੇਂ ਗਾਜਰ ਮਟਰ ਆਲੂ ਗਜਰੇਲਾ ਅਤੇ ਹੋਰ ਗੋਭੀ ਦਾ ਮਨਚੂਰੀਅਨ ਸਰਦੀਆਂ ਦੀਆਂ ਸਬਜ਼ੀਆਂ ਬੱਚੇ ਸ਼ੌਂਕ ਨਾਲ ਖਾਂਦੇ ਹਾਂ ਸਗ ਸਭ ਤੋਂ ਆਸਾਨ ਪਕਵਾਨ ਜਿਹੜਾ ਹੈ ਉਹ ਮੈਨੂੰ ਲੱਗਦਾ ਹੈ ਪਨੀਰ ਦੀ ਭੁਰਜੀ ਜਿਹੜਾ ਕਿ ਕੁਝ ਹੀ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਅਤੇ ਤੁਹਾਨੂੰ ਉਹਦੀ ਕੱਟਣ ਦੀ ਲਿਆਉਣ ਦੀ ਧੋਣ ਦੀ ਜਿਹੜੀ ਆ ਇੰਨੀ ਵੱਡੀ ਸਮੱਸਿਆ ਨਹੀਂ ਹੁੰਦੀ ਦੂਜੀਆਂ ਸਬਜ਼ੀਆਂ ਨੂੰ ਧੋਣਾ ਕੱਟਣਾ ਦੇ ਵਿੱਚ ਸਮਾਂ ਜ਼ਿਆਦਾ ਲੱਗਦਾ ਹੈ ਪਨੀਰ ਦੀ ਭੁਰਜੀ ਦੇ ਵਿੱਚ ਜਿਹੜਾ ਹੈ ਪਾ ਭੁਰ ਪਾ ਪਨੀਰ ਦੇ ਵਿੱਚ ਆਪਾਂ ਅਗਰ ਇਕ ਕਿਲੋ ਦੇ ਕਰੀਬ ਪਿਆਜ਼ ਬਰੀਕ ਕੱਟ ਲਈਏ ਤਾਂ ਉਹਨਾਂ ਨੂੰ ਭੁੰਨ ਲਈਏ ਉਹਦੇ ਵਿੱਚ ਇਕ ਚਮਚਾ ਵੇਸਣ ਦਾ ਵੀ ਸੁੱਟ ਲਈਏ ਉਹਨੂੰ ਭੁੰਨ ਲਈਏ ਉਸ ਤੋਂ ਬਾਅਦ ਉਹਦੇ ਵਿੱਚ ਪਨੀਰ ਪਾ ਕੇ ਅਤੇ ਇੱਕ ਕੋਲੀ ਮਲਾਈ ਦੀ ਵਿੱਚ ਪਾ ਦੇਈਏ ਤਾਂ ਪਨੀਰ ਭੁਰਜੀ ਕੁਝ ਹੀ ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਬਹੁਤ ਹੀ ਸਵਾਦ ਲੱਗਦੀ ਹੈ ਅਤੇ ਕਿਸੇ ਵੇਲੇ ਕੋਈ ਪ੍ਰਾਹੁਣਾ ਜਿਹੜਾ ਵਾ ਉਹ ਅਚਾਨਕ ਆ ਜਾਵੇ ਤਾਂ ਝੱਟ ਹੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਜਾਂ ਫਿਰ ਤੁਸੀਂ ਕੋਈ ਵੀ ਦਾਲ ਬਹੁਤ ਹੀ ਜਲਦੀ ਬਣਾ ਸਕਦੇ ਹੋ ਮਾਂਹ ਛੋਲਿਆਂ ਦੀ ਦਾਲ ਪੰਦਰਾਂ ਵੀਹਾਂ ਮਿੰਟਾਂ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਤੱਕ ਦਾਲ ਬਣਦੀ ਹੈ ਤਦ ਤੱਕ ਉਸਦਾ ਤੜਕਾ ਤਿਆਰ ਕਰ ਲਿਆ ਜਾਂਦਾ ਮੈਨੂੰ ਜਿਹੜਾ ਪਕਵਾਨ ਔਖਾ ਲੱਗਦਾ ਹੈ ਉਹ ਹੈ ਸਾਗ ਸਾਗ ਨੂੰ ਪਹਿਲਾਂ ਲਿਆਓ ਫਿਰ ਉਹਨੂੰ ਚੁਣਨਾ ਪੈਂਦਾ ਹੈ ਚੁਣ ਕੇ ਧੋਣਾ ਪੈਂਦਾ ਹੈ ਧੋ ਕੇ ਜਿਹੜਾ ਉਹ ਸਭ ਤੋਂ ਔਖਾ ਕੰਮ ਲੱਗਦਾ ਹੈ ਉਹ ਦਾਤ ਨਾਲ ਪੈਰਾਂ ਭਾਰ ਬੈਠ ਕੇ ਉਸਨੂੰ ਕੱਟਣ ਦਾ ਪਰ ਸਾਡੇ ਮੰਮੀ ਜੀ ਇਸ ਨੂੰ ਬੜੇ ਹੀ ਸੌਖੇ ਤਰੀਕੇ ਕਰ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਦਾਤ ਨਾਲ ਕੋਈ ਵੀ ਚੀਜ਼ ਕੱਟਣੀ ਚੰਗੀ ਲੱਗਦੀ ਹੈ ਫਿਰ ਸਾਗ ਬਣਦਾ ਹੈ ਅਤੇ ਬਣਨ ਤੋਂ ਬਾਅਦ ਸਵਾਦ ਬਹੁਤ ਲੱਗਦਾ ਹੈ